ਤੁਸੀਂ ਆਪਣੇ ਗੈਸ ਸਿਲੈਂਡਰ ਦੀ ਸਬੂਤੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੋ ਹਾਂਜੀ ਮੈਂ ਆਪਣਾ ਗੈਸ ਦਸ ਤਰੀਕ ਨੂੰ ਬੁੱਕ ਕਰਾਇਆ ਸੀ ਅਤੇ ਹਾਲੇ ਤੱਕ ਸਲੰਡਰ ਮੇਰਾ ਹਾਲੇ ਤੱਕ ਮੇਰਾ ਆਇਆ ਨਹੀਂ ਹੈਗਾ ਜਦੋਂ ਕਿ ਮਤਲਬ ਸਲੰਡਰ ਮੇਰਾ ਲਾਸਟ ਤਰੀਕ ਤੱਕ ਆ ਜਾਣਾ ਚਾਹੀਦਾ ਸੀ ਲਾਸਟ ਮਿਤੀ ਤੱਕ ਆ ਜਾਣਾ ਚਾਹੀਦਾ ਸੀ ਪਰ ਇਹ ਇਸ ਵਾਰੀ ਸਲੰਡਰ ਦੀ ਡੇਟ ਤਾਂ ਪਾਰ ਵੀ ਕਰ ਗਿਆ ਹੈ ਅਤੇ ਫਿਰ ਮੈਨੂੰ ਅਹਿਸਾਸ ਹੋਇਆ ਕਿ ਵੀ ਮੈਨੂੰ ਫੋਨ ਕਰਨਾ ਚਾਹੀਦਾ ਮੈਂ ਫੋਨ ਕਰਕੇ ਫਿਰ ਉਹਨਾਂ ਨੂੰ ਕਿਹਾ ਅਤੇ ਫਿਰ ਉਹਨਾਂ ਨੇ ਸਾਰਾ ਚੈੱਕ ਕਰਕੇ ਵੇਰਵਾ ਵਗੈਰਾ ਅਤੇ ਫਿਰ ਮੈਨੂੰ ਦੱਸਿਆ ਕਿ ਤੁਹਾਡਾ ਸਲੰਡਰ ਤੁਹਾਡੇ ਘਰ ਪਹੁੰਚ ਜਾਏਗਾ ਇੱਕ ਦੋ ਦਿਨ ਤੱਕ